ਯੋਗ ਅਭਿਆਸ ਤੋਂ ਬਾਅਦ ਮੈਂ ਆਪਣੇ ਜੀਵਨ ਦੇ ਵਿੱਚ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਬੜਾ ਹੀ ਵਧੀਆ ਪ੍ਰਭਾਵ ਮਹਿਸੂਸ ਕੀਤਾ ਮੈਂ ਯੋਗਾ ਕਰਨ ਤੋਂ ਬਾਅਦ ਆਪਣੇ ਆਪ ਨੂੰ ਬੜਾ ਹੀ ਬੈਟਰ ਮਹਿਸੂਸ ਕੀਤਾ ਬੜਾ ਹੀ ਰਿਲੈਕਸ ਮਹਿਸੂਸ ਕੀਤਾ ਮਾਇੰਡ ਫਲੈਸ਼ ਹੋ ਗਿਆ ਬੋਡੀ ਰਿਲੈਕਸ ਹੋ ਗਈ ਸਰੀਰ ਦਿਮਾਗ ਦੇ ਵਿੱਚੋਂ ਜੋ ਟੈਂਸ਼ਨਾਂ ਸੀ ਉਹ ਕਾਫੀ ਹੱਦ ਤੱਕ ਖਤਮ ਹੋ ਗਈਆਂ ਯੋਗ ਅਭਿਆਸ ਇੱਕ ਬੜਾ ਹੀ ਵਧੀਆ ਅਭਿਆਸ ਸੀ ਯੋਗਾ ਕਰਨ ਦੇ ਨਾਲ ਨਾਲ ਸਰੀਰ ਇੰਨਾ ਫਿੱਟ ਹੋ ਗਿਆ ਇੰਨਾ ਹਲਕਾ ਹੋ ਗਿਆ ਇੱਦਾਂ ਲੱਗਦਾ ਵੀ ਪਤਾ ਨਹੀਂ ਅੱਜ ਕਿ ਕੀਤਾ ਇਹੋ ਜਿਹਾ ਵੀ ਅੱਜ ਮਾਇੰਡ ਵੀ ਫਰੈਸ਼ ਹੈ ਬਾਡੀ ਵੀ ਫਰੈਸ਼ ਹੈ ਸਰੀਰ ਐਕਟਿਵ ਹੋ ਗਿਆ ਕੰਮ ਜਲਦੀ ਜਲਦੀ ਸਾਰੇ ਖਤਮ ਹੋ ਗਏ ਅਤੇ ਦਿਲ ਵੀ ਬੜਾ ਖੁਸ਼ ਹੋਇਆ ਮਤਲਬ ਉਂਝ ਵੀ ਬੜੀ ਖੁਸ਼ੀ ਮਿਲੀ ਆਪਦੇ ਆਪ ਨੂੰ ਯੋਗਾ ਇੱਕ ਬਹੁਤ ਹੀ ਵਧੀਆ ਚੀਜ਼ ਹੈ ਇਸ ਨੇ ਬੜਾ ਹੀ ਸਰੀਰ ਦੇ ਉੱਤੇ ਜੀਵਨ ਦੇ ਉੱਤੇ ਬੜਾ ਵਧੀਆ ਪ੍ਰਭਾਵ ਪਾਇਆ ਕਾਫੀ ਹੱਦ ਤੱਕ ਸਾਡੀਆਂ ਟੈਨਸ਼ਨਾਂ ਖਤਮ ਹੋ ਚੁੱਕੀਆਂ ਯੋਗਾ ਕਰਨ ਨਾਲ ਅਸੀਂ ਕਈ ਇਮੋਸ਼ਨਲ ਚੀਜ਼ਾਂ ਨੂੰ ਆਪਣੇ ਜੋ ਵੀ ਜੀਵਨ ਵਿੱਚ ਚੱਲ ਰਹੀਆਂ ਉਹਨਾਂ ਨੂੰ ਹੌਲੀ ਹੌਲੀ ਦਿਮਾਗ ਵਿੱਚੋਂ ਕੱਢ ਚੁੱਕੇ ਹਾਂ ਭੁੱਲ ਚੁੱਕੇ ਹਾਂ ਅਤੇ ਬੜਾ ਹੀ ਮਤਲਬ ਦਿਲ ਖੁਸ਼ ਰਹਿਣ ਲੱਗ ਗਿਆ ਯੋਗਾ ਕਰਨ ਨਾਲ ਕਾਫੀ ਬਿਮਾਰੀਆਂ ਵੀ ਠੀਕ ਹੋ ਗਈਆਂ ਜਿਹੜੀਆਂ ਰੋਜ਼ਾਨਾ ਬੀ ਪੀ ਦੀ ਗੋਲੀ ਲੈਂਦੇ ਸੀ ਬਜ਼ਾਰੋਂ ਰੋਜ਼ਾਨਾ ਸਰਵਾਈਕਲ ਦੀ ਲੈਂਦੇ ਸੀ ਉਹ ਲੈਂਦੇ ਸੀ ਸਾਰੀਆਂ ਮੈਡੀਸਨ ਵੀ ਚੱਕੀਆਂ ਗਈਆਂ ਫਿਰ ਸਰੀਰ ਰਿਲੈਕਸ ਹੋ ਗਿਆ ਅਤੇ ਬਾਡੀ ਫਿੱਟ ਰਹਿਣ ਲੱਗ ਗਈ ਅਤੇ ਬੜਾ ਹੀ ਵਧੀਆ ਅਭਿਆਸ ਸੀ ਯੋਗਾ ਦਾ